ਪਿੱਠ ਦੇ ਦਰਦ ਨੂੰ ਠੀਕ ਕਰਨ ਲਈ ਮੇਰੇ ਪਿੰਡ ਵਿੱਚ ਬਹੁਤ ਸਾਰੇ ਘਰੇਲੂ ਨੁਸਖੇ ਅਪਣਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਹੈ ਕਿ ਬੰਦੇ ਨੂੰ ਮੂਧਾ ਸੁਆ ਕੇ ਉਸਦੇ ਪੈਰਾਂ ਰਾਹੀਂ ਪਟਾਕੇ ਕੱਢੇ ਜਾਂਦੇ ਹਨ ਜਿਸ ਤੋਂ ਪੂਰੇ ਸਰੀਰ ਵਿੱਚ ਖਿਚਾਵ ਪੈਦਾ ਹੁੰਦਾ ਹੈ ਤਾਂ ਪਿੱਠ ਦੇ ਜੋੜ ਵੀ ਖੁੱਲ੍ਹਦੇ ਅਤੇ ਠੀਕ ਹੁੰਦੇ ਹਨ